ਡਰਾਇੰਗ ਇੱਕ ਐਸਾ ਵਿਸ਼ਾ ਹੈ ਜਿਸ ਵਿੱਚ ਇੱਕ ਇਨਸਾਨ ਆਪਣੇ ਮਨ ਦੇ ਭਾਵ ਮਨ ਦੇ ਭਾਵਾਂ ਨੂੰ ਚਿੱਤਰ ਵਿੱਚ ਜਾਂ ਕਿਸੇ ਪਿਕਚਰ ਦੇ ਵਿੱਚ ਬਦਲ ਕੇ ਆਪਣੇ ਭਾਵਾਂ ਨੂੰ ਦਰਸਾਉਂਦਾ ਹੈ ਇਸ ਜਿਹੜੇ ਜਿਹੜੀ ਡਰਾਇੰਗ ਹੈ ਅੱਜ ਕੱਲ੍ਹ ਅੱਜ ਕੱਲ੍ਹ ਆਮ ਇਹ ਸਕੂਲਾਂ ਵਿੱਚ ਇੱਕ ਵਿਸ਼ਾ ਹੈ ਜਿਸ ਵਿੱਚ ਸ ਸਾਰੇ ਵਿਦਿਆਰਥੀ ਕੁਛ ਨਾ ਕੁਛ ਬਣਾਉਂਦੇ ਹਨ ਹਰ ਵਿਦਿਆਰਥੀ ਦੀ ਆਪਣੀ ਇੱਕ ਸੋਚ ਹੁੰਦੀ ਆ ਜਿਸ ਨਾਲ ਉਹ ਜਿਸ ਨਾਲ ਆਪਣੀ ਉਹ ਸੋਚ ਆਪਣੀ ਸੋਚ ਨੂੰ ਦਰਸਾਉਂਦਾ ਹੈ ਉਹ ਆਪਣੀ ਡਰਾਇੰਗ ਵਿੱਚ ਆਪਣੀ ਸੋਚ ਨੂੰ ਦਰਸਾਉਂਦਾ ਹੈ ਅਤੇ ਜਿਹੜੀ ਡਰਾਇੰਗ ਹੈ ਉਹਦੇ ਵਿੱਚ ਯਥਾਰਥਵਾਦ ਮਤਲਬ ਰਿਐਲਿਟੀ ਦਾ ਬਹੁਤ ਇੱਕ ਵੱਡਾ ਇਮਪੋਰਟੈਂਸ ਹੁੰਦਾ ਇੱਕ ਵੱਡਾ ਹਿੱਸਾ ਹੁੰਦਾ ਹੈ ਕਿ ਜੋ ਚੀਜ਼ ਰਿਐਲਿਟੀ 'ਚ ਹੈ ਉਹ ਆਪਾਂ ਕਿਸੇ ਨੂੰ ਦਿਖਾਉਣਾ ਹੈ ਅਤੇ ਉਹ ਆਪਾਂ ਡਰਾਇੰਗ ਥਰੂ ਦਿਖਾ ਸਕਦੇ ਹਾਂ ਲੇਕਿਨ ਹਰ ਬੰਦੇ ਦੀ ਆਪਦੀ ਸੋਚ ਹੁੰਦੀ ਹੈ ਆਪਦੇ ਉਹਨਾਂ ਉਹਦੇ ਵਿਚਾਰ ਹੁੰਦੇ ਹੈ ਅਤੇ ਉਹਦੇ ਆਪਦੇ ਸੋਚਾਂ ਵਿਚਾਰਾਂ ਨਾਲ ਉਹਦੀ ਆਪਦੀ ਇੱਕ ਰਚਨਾਤਮਕ ਰੁਚੀ ਹੁੰਦੀ ਹੈ ਇੱਕ ਉਹਦੀ ਆਪਦੀ ਕ੍ਰਏਟੀਵਿਟੀ ਹੁੰਦੀ ਹੈ ਜਿਹੜੀ ਕਿ ਆਪਦੇ ਜਿਹੜੀ ਕਿਸੇ ਵੀ ਟੋਪਿਕ ਨੂੰ ਆਪਣੇ ਉਹ ਆਪਣੀ ਸੋਚ ਦੇ ਅਧਾਰ 'ਤੇ ਦੂਜੇ ਨੂੰ ਪ੍ਰਗਟ ਕਰਦਾ ਹੈ ਅਤੇ ਜਿਹੜੀ ਡਰਾਇੰਗ ਹੈ ਉਹਦੇ ਵਿੱਚ ਜੇ ਕੋਈ ਅਗਰ ਕੋਈ ਡਰਾਇੰਗ ਹੈ ਉਹਦੇ ਵਿੱਚ ਸਾਫ ਸਾਫ ਕਿਸੇ ਦੇ ਬੰਦੇ ਡਰਾਇੰਗ ਬਣਾਉਣ ਵਾਲੇ ਦੇ ਭਾਵ ਸਾਫ ਸਾਫ ਦਿਖਦੇ ਹਨ ਅਤੇ ਉਹ ਸਾਹਮਣੇ ਵਾਲੇ ਨੂੰ ਆਕਰਸ਼ਿਤ ਕਰਦੇ ਹਨ ਅਤੇ ਕਰਤਾ ਦੀ ਕਰਤਾ ਦੀਆਂ ਭਾਵਨਾਵਾਂ ਨੂੰ ਦੂਜੇ ਦੇ ਸਾਹਮਣੇ ਦਰਸਾਉਂਦੇ ਹਨ